ਖੇਡ ਖੇਡਣ ਦੌਰਾਨ ਬਹੁਤ ਸਾਰੇ ਬੱਚੇ ਜਖ਼ਮੀ ਹੋ ਜਾਂਦੇ ਹਨ ਜਾਂ ਕਈ ਹੋਰ ਇਹੋ ਜਿਹੇ ਹਾਦਸਾ ਸਾਹਮਣਾ ਕਰਦੇ ਹਨ ਜਿਹਨਾਂ ਨਾਲ ਕਿ ਉਹਨਾਂ ਦਾ ਸਰੀਰ ਕਾਫ਼ੀ ਬੇਢੰਗਾ ਬਣ ਜਾਂਦਾ ਹੈ ਇੱਥੋਂ ਤੱਕ ਕਿ ਖੇਡਦੇ ਖੇਡਦੇ ਕਈ ਵਾਰ ਕੋਈ ਹੱਡੀ ਕਰੈਕ ਹੋ ਜਾਂਦੀ ਹੈ ਤਾਂ ਉਸ ਵੇਲੇ ਕੌਚ ਜੋ ਕਿ ਸਪੋਟਸ ਦਾ ਕੰਮ ਕਰ ਰਿਹਾ ਹੈ ਤਾਂ ਉਹਨਾਂ ਬੱਚਿਆਂ ਨੂੰ ਉਹ ਫ਼ਸਟ ਏਡ ਦਿੰਦਾ ਹੈ ਅਗਰ ਜ਼ਿਆਦਾ ਕੋਈ ਸੀਰੀਅਸ ਕੇਸ ਹੈ ਤਾਂ ਉਸਨੂੰ ਉਹ ਨੇੜੇ ਦੇ ਹਸਪਤਾਲ ਜਿਵੇਂ ਕਿ ਸੁਰਜੀਤ ਸੁਰਜੀਤ ਹੌਸਪੀਟਲ ਹੈ ਬਲਜਿੰਦਰਾ ਹੌਸਪੀਟਲ ਹੈ ਪਰਮਾਰ ਹੌਸਪੀਟਲ ਹੈ ਆਦਿ ਹਸਪਤਾਲਾਂ ਦੇ ਵਿੱਚ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਉਹਨਾਂ ਵਿੱਚ ਪਹੁੰਚਾ ਦਿੰਦਾ ਹੈ ਜਿੱਥੇ ਕਿ ਉਹਨਾਂ ਦਾ ਇਲਾਜ ਚੰਗੇ ਢੰਗ ਨਾਲ ਹੋ ਜਾਂਦਾ ਹੈ